ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਜੀ

ਹਾਂਜੀ ਉਹ ਜਿਹੜੇ ਸਾ ਰਹਿੰਦੇ ਹੁੰਦੇ ਸੀ ਪਹਿਲਾਂ ਇੱਥੇ ਸਾਡੇ ਕੋਲ ਸਾਡੇ ਹਾਂਜੀ ਹਾਂ ਹਾਂ ਠੀਕ ਹੈ ਠੀਕ ਹੈ ਜੀ ਜੀ ਜੀ ਹਾਂਜੀ ਹਾਂਜੀ

ਅੱਛਾ ਠੀਕ ਹੈ ਹਾਂਜੀ ਹਾਂਜੀ ਆਜੋ ਜੀ ਆਜੋ ਹਮ ਜੀ ਜੀ ਹਾਂਜੀ ਹਾਂ ਜਿੱਥੇ ਅਸੀਂ ਰਹਿੰਦੇ ਹਾਂ ਜੀ ਉਹਦੇ ਨਾਲ ਹੈਗੀ ਜੀ ਪੀ ਜੀ ਹਾਂਜੀ ਹਾਂ ਉੱਥੇ ਹੀ ਰਹਿੰਦੇ ਹੁੰਦੇ ਸੀ ਉ ਮੇਰੀ ਹਾਂਜੀ ਹਾਂ ਉੱਥੇ ਹਾਂਜੀ ਹਾਂ ਇੱਥੇ ਪੀ ਜੀ ਜਿਹੜਾ ਮਤਲਬ ਹਾਂਜੀ ਉਹਦੇ ਵਿੱਚ ਜਿਹੜੀ ਹੁਣ ਇੱਥੇ ਨੇੜੇ ਹੈਗੀ ਸਾਡੇ ਪੀ ਜੀ ਇੱਥੇ ਨਾ ਕੰਟੀਨ ਨਹੀਂ ਹੈ ਉਹ ਉਹਦੇ ਵਿੱਚ ਖਾਣਾ ਪੀਣਾ ਬਹੁਤ ਵਧੀਆ ਉਹਦੇ 'ਚ ਸਾਫ ਸੁਥਰਾ ਬਣਦਾ ਹੈ ਜੀ ਅਤੇ ਉਹ ਪੰਜ ਛੇ ਹਜ਼ਾਰ ਵਿੱਚ ਦੋਏ ਟਾਈਮ ਦਾ ਖਾਣਾ ਵੀ ਦੇ ਦਿੰਦੇ ਹੈ ਵਾਈ ਫਾਈ ਫੈਸਲਿਟੀ ਵੀ ਹੈਗੀ ਹੈ ਜੀ ਇੱਕ ਇੱਥੇ ਫੇ ਹਾਂਜੀ ਹਾਂ ਫਿਰ ਗੁਰਦੁਆਰਾ ਸਾਹਿਬ ਵੀ ਨੇੜੇ ਹੈ ਜੀ ਉਦੇ ਪੀ ਜੀ ਏ ਤੁਸੀਂ ਚੱਲੋ ਹੈ ਨਾ ਹਾਂਜੀ ਕਈ ਵਾਰੀ ਬੱਚੇ ਵੀ ਆਪਾਂ ਸਭ ਨੂੰ ਹੁੰਦਾ ਹੀ ਹੈ ਨਾ ਪੇਪਰਾਂ ਦੇ ਟਾਈਮ ਆਪਾਂ ਭੱਜਦੇ ਹਾਂ ਗੁਰਦੁਆਰੇ 'ਚ ਹੈ ਨਾ ਜੀ ਅਤੇ ਹਾਂ ਹਾਂ ਵੀ ਤਾਂ ਕਰਕੇ ਬਹੁਤ ਵਧੀਆ ਹੈ ਜੀ ਵਧੀਆ ਫੈਸਿਲਿਟੀ ਹੈ ਜੀ ਅਤੇ ਇੱਥੇ ਰਹਿਣ ਸਹਿਣ ਵੀ ਵਧੀਆ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ ਅੱਛਾ ਜਿਹੜਾ ਗਰੁੱਪ ਵਾਈਜ਼ ਹੈ ਕੁੜੀਆਂ ਉਹ ਵੀ ਵਧੀਆਂ ਰਹਿੰਦੀਆਂ ਨੇ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਦੇ ਸੁਣੀ ਨਹੀਂ ਹੈਗੀ ਅਸੀਂ ਠੀਕ ਹੈ ਨਾ ਜੀ ਹਾਂ ਹਾਂ ਹਾਂਜੀ ਹਾਂ ਹਾਂਜੀ ਹਾਂ ਜੀ ਜੀ ਤੁਸੀਂ ਆਜੋ ਜੀ ਫਿਰ ਆਪਾਂ ਮਿਲ ਬੈਠ ਕੇ ਗੱਲ ਕਰਦੇ ਹਾਂ ਜੀ ਹੈ ਨਾ ਤੁਸੀਂ ਆ ਜੂੰਗੇ ਸਾਡੇ ਹੀ ਆ ਜਿਓ ਅਸੀਂ ਤੁਹਾਨੂੰ ਉੱਥੇ ਲੈ ਜਾ ਹਾਂਜੀ ਹਾਂਜੀ ਫ਼ਰੀ ਹੈ ਜੀ ਤੁਸੀਂ ਆ ਜਿਓ ਜਦ ਮਰਜ਼ੀ ਠੀਕ ਹੈ ਜੀ ਹਾਂਜੀ ਓਕੇ ਜੀ ਮਿਲਦੇ ਹਾਂ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਓਕੇ ਜੀ